ਮੈਂ ਇੱਕ ਵਾਰ ਇੱਕ ਜੀਨ ਦੀ ਪੈਂਟ ਖਰੀਦੀ ਜਿਹੜੀ ਕਿ ਮੈਂ ਇੱਕ ਔਨਲਾਈਨ ਐਪ ਤੋਂ ਖਰੀਦੀ ਸੀ ਉਹ ਪੈਂਟ ਸੀ ਵੀ ਇੱਕ ਚੰਗੀ ਕੰਪਨੀ ਦੀ ਔਰ ਉਹਦਾ ਰੇਟ ਵੀ ਜਿਹੜਾ ਮੈਂ ਚੰਗਾ ਪੇ ਕੀਤਾ ਸੀ ਪਰ ਜਦੋਂ ਉਹਨੂੰ ਮੈਂ ਵਰਤ ਕੇ ਦੇਖਿਆ ਤਾਂ ਉਹ ਬਹੁਤ ਛੇਤੀ ਜਿਹੜੀ ਮੇਰੇ ਮਨੋ ਲਹਿ ਗਈ ਮਨੋ ਲਹਿਣ ਦਾ ਕਾਰਨ ਇਹ ਸੀ ਕਿ ਇੱਕ ਤਾਂ ਜਦੋਂ ਉਹਨੂੰ ਪਹਿਲੇ ਦੋ ਧੋਆਂ ਦੇ ਵਿੱਚ ਹੀ ਉਹਦਾ ਜਿਹੜਾ ਰੰਗ ਆ ਉਹ ਨਿਕਲ ਗਿਆ ਸੀ ਤਾਂ ਰੰਗ ਨਿਕਲਣ ਤੋਂ ਬਾਅਦ ਉਹ ਜਿਹੜੀ ਇਕੱਠੀ ਹੋਣੀ ਵੀ ਸ਼ੁਰੂ ਹੋ ਗਈ ਸੀ ਜਿਹਨੂੰ ਆਪਾਂ ਸ਼ਰਿੰਕ ਕਹਿ ਦਿੰਦੇ ਸ਼ਰਿੰਕ ਹੋਣ ਲੱਗ ਗਈ ਸੀ ਤਾਂ ਉਹ ਮੇਰੇ ਪਹਿਲਾਂ ਨਾਲੋਂ ਟਾਈਟ ਵੀ ਹੋ ਗਈ ਜਿੰਨਾ ਕ ਉਹਨਾਂ ਨੇ ਰੇਟਿੰਗ 'ਚ ਮੈਂ ਉਹਦਾ ਦੇਖਿਆ ਸੀ ਤਾਂ ਉਹਦੇ ਤੋਂ ਤਾਂ ਉਹ ਬਹੁਤ ਹੀ ਜਿਹੜੀ ਪਿੱਛੇ ਰਹੀ ਕਿਉਂਕਿ ਉਹਦਾ ਜਿਹੜਾ ਫੈਬਰਿਕ ਆ ਕੱਪੜਾ ਵੀ ਇੰਨਾ ਜਿਹੜਾ ਵਧੀਆ ਨਹੀਂ ਸੀ ਤਾਂ ਉਹ ਉਸ ਤੋਂ ਬਾਅਦ ਜਦੋਂ ਉਹਨੂੰ ਮੈਂ ਪਾਉਣੀ ਵੀ ਉਹ ਛੱਡ ਦਿੱਤੀ ਕਿਉਂਕਿ ਉਹ ਮੇਰੇ ਓਨੀ ਮਨ ਨੂੰ ਲੱਗੀ ਹੀ ਨਹੀਂ ਉਹ ਤੋਂ ਬਾਅਦ ਜਿਹੜਾ ਫਿਰ ਔਨਲਾਈਨ ਸ਼ਾਪਿੰਗ ਤੋਂ ਕਹਿ ਲਓ ਜਾਂ ਇੱਦਾਂ ਦੀ ਚੀਜ਼ ਜਿਹੜੀ ਆ ਔਨਲਾਈਨ ਮੰਗਾਉਣ ਤੋਂ ਮੈਂ ਜਿਹੜਾ ਗੁਰੇਜ਼ ਕਰਨ ਲੱਗਿਆ ਅਤੇ ਉਹ ਖਰੀਦ ਕੇ ਪੈਂਟ ਮੈਨੂੰ ਉਹ ਬਹੁਤ ਨਿਰਾਸ਼ਾ ਹੋਈ